ਇੱਥੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ ਜੋ ਇੰਜਨੀਅਰਿੰਗ ਕੋਲਜਾਂ ਦੇ ਵੱਖ ਵੱਖ ਵਿਭਾਗਾਂ ਵਿੱਚ ਵੱਖ ਵੱਖ ਕੋਰਸਾਂ ਦੀ ਪੇਸ਼ਕਸ਼ ਕਰਦੀਆਂ ਹਨ ਉਹ ਹਨ ਕੰਪਿਊਟਰ ਵਿਗਿਆਨ ਸੂਚਨਾ ਟੈਕਨੋਲਜੀ ਇਲੈਕਟ੍ਰੀਕਲ ਮਕੈਨੀਕਲ ਅਤੇ ਰਸਾਇਣਿਕ ਇੰਜਨੀਅਰਿੰਗ ਵਿਦਿਆਰਥੀਆਂ ਲਈ ਇਹਨਾਂ ਖੇਤਰਾਂ ਵਿੱਚ ਕਰੀਅਰ ਦੇ ਬਹੁਤ ਮੌਕੇ ਹਨ